ਪੰਜਾਬ ਵਿੱਚ ਬਹੁਤ ਸਾਰੇ ਮੁੱਖ ਸੱਭਿਆਚਾਰਕ ਤਿਉਹਾਰ ਅਤੇ ਸਮਾਗਮ ਹਨ ਇਹਨਾਂ ਨੂੰ ਮਨਾਉਣ ਲਈ ਬਹੁਤ ਸਾਰੀ ਪਰੰਪਰਾਵਾਂ ਭਾਈਚਾਰਾ ਅਤੇ ਬਹੁਤ ਸਾਰੀ ਖੁਸ਼ੀਆਂ ਹਨ ਪੰਜਾਬ ਜਿਵੇਂ ਕਿ ਛਪਾਰ ਮੇਲਾ ਲੋਹੜੀ ਬਸੰਤ ਪੰਚਮੀ ਲੋਹੜੀ ਇੱਕ ਪੰਜਾਬ ਦਾ ਬਹੁਤ ਵੱਡਾ ਮਨਾਉਣ ਜਾਣ ਵਾਲਾ ਤਿਉਹਾਰ ਅਤੇ ਉੱਤਰ ਭਾਰਤ ਦਾ ਪ੍ਰਮੁੱਖ ਮਨਾਏ ਜਾਣੇ ਵਾਲਾ ਤਿਉਹਾਰ ਹੈ ਇਸ ਵਿੱਚ ਲੋਕ ਆਪਣੇ ਸਾਰੀ ਸਾ ਸਾਰੀ ਦੀ ਸਾਰੀ ਗਲਤੀਆਂ ਅਤੇ ਨੈਗਟਿਵ ਪ੍ਰਭਾਵ ਨੂੰ ਲੋਹੜੀ ਦੇ ਅੱਗ ਵਿੱਚ ਬਾਲ ਦਿੰਦੇ ਹਨ ਅਤੇ ਸਾਰੇ ਆਪਣੇ ਪਰਿਵਾਰ ਨਾਲ ਮਿਲ ਜੁਲ ਕੇ ਖੁਸ਼ੀਆਂ ਮਨਾਉਂਦੇ ਹਨ ਇਸ ਵਿੱਚ ਸਵੇਰੇ ਸਵੇਰੇ ਲੋਕ ਅਤੇ ਮੁੰਡੇ ਅਤੇ ਕੁੜੀਆਂ ਸਾਰੇ ਮਿਲ ਕੇ ਗੁੱਡੀਆਂ ਗੁੱਡੀਆਂ ਉਡਾਉਂਦੇ ਹਨ ਅਤੇ ਗਾਣੇ ਲਾ ਕੇ ਨੱਚਦੇ ਹਨ ਅਤੇ ਉਹਨਾਂ ਦੇ ਪਰਿਵਾਰ ਰਾਤੀਂ ਲੋਹੜੀ ਬਾਲ ਕੇ ਜਸ਼ਨ ਮਨਾਉਂਦੇ ਹਨ ਅਤੇ ਲੋਹੜੀ ਇੱਕ ਖੁਸ਼ੀਆਂ ਦਾ ਤਿਉਹਾਰ ਹੈ ਅਤੇ ਇਸ ਤਰ੍ਹਾਂ ਹੀ ਭਾਈਚਾਰਾ ਅਤੇ ਪਰੰਪਰਾਵਾਂ ਨੂੰ ਨਿਭਾਉਣ ਲਈ ਪੰਜਾਬ ਵਿੱਚ ਬਹੁਤ ਸਾਰੇ ਮੁੱਖ ਸੱਭਿਆਚਾਰਕ ਤਿਉਹਾਰ ਅਤੇ ਸਮਾਗਮ ਹੋਣੇ